ਸਤਿ ਸ਼੍ਰੀ ਅਕਾਲ ਜੀ ਪੰਜਾਬ ਦਾ ਜਿਹੜਾ ਲੋਕ ਡਾਂਸ ਆ ਉਹ ਹੈਗਾ ਗਿੱਧਾ ਮੁਟਿਆਰਾਂ ਦਾ ਗਿੱਧਾ ਅਤੇ ਗੱਭਰੂਆਂ ਦਾ ਭੰਗੜਾ ਇਹ ਦੋ ਫੇਮਸ ਲੋਕ ਡਾਂਸ ਮੰਨੇ ਗਏ ਲੋਕ ਨਾਚ ਮੰਨੇ ਗਏ ਆ ਸਾਡੇ ਜਿਹੜੀਆਂ ਮੁਟਿਆਰਾਂ ਹੈ ਉਹ ਗਿੱਧਾ ਪਾਉਂਦੀਆਂ ਆ ਜਦੋਂ ਗਿੱਧਾ ਪਾਉਂਦੀਆਂ ਉਹ ਪੂਰੇ ਜੋਸ਼ 'ਚ ਪਾਉਂਦੀਆਂ ਉਹਨਾਂ ਦਾ ਜਿਹੜਾ ਜੋਸ਼ ਹੁੰਦਾ ਨਾ ਉਹ ਉਹਨਾਂ ਦਾ ਤਾਂ ਹੁੰਦਾ ਹੀ ਆ ਜਿਹੜੇ ਉੱਥੇ ਬੈਠੀ ਜਨਤਾ ਹੁੰਦੀ ਹੈ ਸਾਡੀ ਉਹ ਵੀ ਮਤਲਬ ਕਿ ਹੁੰਦੀ ਆ ਕਿ ਹਾਏ ਹੁਣ ਅਸੀਂ ਵੀ ਮਤਲਬ ਕਿ ਸ਼ੁਰੂ ਹੋ ਜੀਏ ਅਸੀਂ ਵੀ ਨੱਚਣਾ ਸ਼ੁਰੂ ਕਰ ਦੇਈਏ ਇੱਦਾਂ ਦਾ ਮਤਲਬ ਉਹਨਾਂ ਦੀ ਇੱਦਾਂ ਦੀਆਂ ਕੁਛ ਐਨਰਜੀ ਹੁੰਦੀ ਉਹਨਾਂ ਦੀ ਅਤੇ ਜਿਹੜੇ ਗੱਭਰੂ ਹੁੰਦੇ ਭੰਗੜਾ ਪਾਉਣ ਵਾਲੇ ਸਾਡੇ ਲੁੱਡੀ ਵਾਲੇ ਉਹ ਵੀ ਜਦੋਂ ਲੁੱਡੀ ਪਾਉਂਦੇ ਆ ਚਲੋ ਲੁੱਡੀ ਦੀ ਚਾਲ ਚੱਕਦੇ ਆ ਨਾ ਉੱਥੇ ਬੈਠੀ ਜਨਤਾ ਬਸ ਕਿ ਅਸੀਂ ਵੀ ਹੁਣ ਇਹਨਾਂ ਦੇ ਨਾਲ ਹੀ ਹੋ ਜਾਈਏ ਸ਼ੁਰੂ ਮਤਲਬ ਇਹ ਦੋਵੇਂ ਜਿਹੜੇ ਡਾਂਸ ਆ ਨਾ ਕਿ ਡਾਂਸ ਫੋਰਮਸ ਆ ਇਹ ਇੱਦਾਂ ਦੀਆਂ ਕੁਛ ਹੈਗੀਆਂ ਨੇ ਕਿ ਜਦੋਂ ਬੰਦਾ ਨੱਚਦਾ ਆ ਨਾ ਉਹ ਖੁਦ ਨਹੀਂ ਨੱਚਦਾ ਉਹ ਦੂਜਿਆਂ ਨੂੰ ਵੀ ਆਪਣੀ ਜਿਹੜੀ ਆ ਨਾ ਉਹ ਫੀਲਿੰਗ ਉਹ ਪਾਸ ਕਰਦਾ ਵਾ ਕਿ ਉਹ ਵੀ ਬੰਦਾ ਫੀਲ ਕਰਦਾ ਵਾ ਅਤੇ ਮੈਂ ਕਹਿੰਦੀ ਹਾਂ ਕਿ ਜਿਹੜਾ ਹੁਣ ਜਿਹੜਾ ਜੇ ਮੈਂ ਸੰਗੀਤ ਵਜੋਂ ਗੱਲ ਕਰਾਂ ਤਾਂ ਸੰਗੀਤ ਦਾ ਜਿਹੜਾ ਹੈਗਾ ਉਹ ਤਿਉਹਾਰ ਲੋਹੜੀ ਜਿੱਦਾਂ ਤਾਂ ਆਪਾਂ ਸਾ ਜਿਹੜੀਆਂ ਕੁੜੀਆਂ ਹੁੰਦੀਆਂ ਉਹਨਾਂ ਨੂੰ ਤਿਉਹਾਰ ਦੀ ਵੇਟ ਰਹਿੰਦੀ ਆ ਲੋਹੜੀ ਦੀ ਕਿ ਕਦੋਂ ਲੋਹੜੀ ਆਵੇ ਅਤੇ ਕਦੋਂ ਜਾਣ ਉਹ ਲੋਹੜੀ ਮੰਗਣ ਉਹ ਲੋਹੜੀ ਮੰਗਦੀਆਂ ਵਾ ਜਿੱਦਾਂ ਆਪਣਾ ਗਾਉਂਦੇ ਹੁੰਦੇ ਆ ਹੈ ਨਾ ਤੁਸੀਂ ਸ਼ਾਇਦ ਸੁਣਿਆ ਹੋਵੇ ਨਿੱਕੇ ਹੁੰਦੇ ਹੁਣ ਮੈਂ ਤੁਹਾਨੂੰ ਦੋ ਕੁ ਲਾਈਨਾਂ ਸੁਣਾਈਆਂ ਤੁਸੀਂ ਤੁਹਾਡਾ ਵੀ ਮਨ ਖੁਸ਼ ਹੋ ਗਿਆ ਹੋਣਾ ਤੁਹਾਨੂੰ ਵੀ ਆਪਣਾ ਟਾਈਮ ਕਿਤੇ ਨਾ ਕਿਤੇ ਯਾਦ ਆ ਹੀ ਗਿਆ ਹੋਣਾ ਇੱਦਾਂ ਹੀ ਬਸ ਛੋਟੇ ਛੋਟੀਆਂ ਚੀਜ਼ਾਂ ਆ ਜਿੱਦਾਂ ਕਿ ਆਪਣਾ ਹੈਗੀਆਂ ਆ ਇਹ ਬਹੁਤ ਮਤਲਬ ਫੇਮਸ ਆ ਅਤੇ ਦਿਲ ਨੂੰ ਖੁਸ਼ ਕਰਨ ਵਾਲੀਆਂ ਆ ਮੈਂ ਯਾਦ ਕਰਦੀ ਹਾਂ ਇਹਨਾਂ ਚੀਜ਼ਾਂ ਨੂੰ ਅਤੇ ਜਦੋਂ ਵੀ ਇਹਨਾਂ ਦੀ ਇਹਨਾਂ ਬਾਰੇ ਸੋਚੀਏ ਵੀ ਨਾ ਤਾਂ ਬੰਦਾ ਇਹਨਾਂ ਨੂੰ ਸੋਚਦੇ ਹੀ ਮਹਿਸੂਸ ਕਰਦਾ ਹੈ ਧੰਨਵਾਦ ਜੀ